ਹੈਲੋ ਹਾਂਜੀ ਹਾਂਜੀ ਸਾਡੇ ਇੱਥੇ ਹਿਮਾਲਿਆ ਬੇਕਰਜ਼ ਅਤੇ ਵਿਨੀ ਬੇਕਰਜ਼ ਕਾਫੀ ਮਸ਼ਹੂਰ ਹੈ ਇਹ ਇਹਨਾਂ ਦੀ ਜਿਹੜੀ ਵਧੀਆ ਕੁਆਲਿਟੀਜ਼ ਨੇ ਉਹ ਇਹ ਨੇ ਕਿ ਇੱਕ ਤਾਂ ਇਹ ਫਰੈਸ਼ ਆਈਟਮਸ ਪ੍ਰੋਵਾਈਡ ਕਰਦੀਆਂ ਅਤੇ ਦੂਜਾ ਇਹ ਪੂਰਾ ਮਤਲਬ ਕਿ ਵੈਜੀਟੇਰੀਅਨ ਪ੍ਰੋਡਕਟਸ ਰੱਖਦੇ ਆ ਇਹ ਦੋਨੋਂ ਐਪਸ 'ਤੇ ਅਵੇਲੇਬਲ ਨੇ ਜਮੈਟੋ ਅਤੇ ਸਵੀਗੀ ਉਹ ਮਤਲਬ ਕਿ ਵੀਹ ਪੱਚੀ ਮਿੰਟ ਦੀ ਟਾਈਮ ਡਿਊਰੇਸ਼ਨ ਦੇ ਵਿੱਚ ਅ ਡਿਲੀਵਰ ਕਰ ਦਿੱਤੇ ਆ ਜਿਵੇਂ ਕਿ ਇਹਨਾਂ ਦਾ ਛੋਟਾ ਕੇਕ ਆ ਫੋਰ ਹੰਡਰਡ ਤੋਂ ਸਟਾਰਟ ਹੋ ਜਾਂਦਾ ਅਤੇ ਪੇਸਟਰੀਸ ਇਹਨਾਂ ਦੀਆਂ ਫਿਫਟੀ ਤੋਂ ਸਟਾਰਟ ਹੋ ਜਾਂਦੀਆਂ ਜਿੱਦਾਂ ਡਾਰਕ ਫੋਰੈਸਟ ਇਹਨਾਂ ਦੀ ਸੈਵਨਟੀ ਫਾਈਵ ਦੀ ਆ ਕਿੱਟਕੈਟ ਕੇਕ ਇਹਨਾਂ ਦਾ ਫਾਈਵ ਫੀਫਟੀ ਦਾ ਆ ਸਵੀਟ ਡਿਸ਼ ਵਿੱਚ ਇਹਨਾਂ ਨੇ ਕੀ ਕਹਿੰਦੇ ਆ ਇਹਨਾਂ ਦੀ ਉਹ ਰਸ ਮਲਾਈ ਫੇਮਸ ਆ ਅਤੇ ਕੀ ਕਹਿੰਦੇ ਆ ਪੈਟੀਜ਼ ਵਗੈਰਾ ਕਰੀਮ ਰੋਲਜ਼ ਵਗੈਰਾ ਕਾਫੀ ਮਸ਼ਹੂਰ ਨੇ ਇਹਨਾਂ ਦੇ ਹਾਂਜੀ ਹਾਂਜੀ ਕਈ ਵਾਰ ਤੀਹ ਮਿੰਟ 'ਚ ਕਰ ਦਿੰਦੇ ਆ ਕਈ ਵਾਰੀ ਟਾਈਮ ਤੋਂ ਪਹਿਲਾਂ ਵੀ ਕਰ ਦਿੰਦੇ ਨੇ